ਹਾਂਜੀ ਮੈਂ ਮਤਲਬ ਕਿ ਬਹੁਤ ਹੀ ਜ਼ਿਆਦਾ ਘੁੰਮਣਾ ਪਸੰਦ ਕਰਦੀ ਹਾਂ ਮੈਂ ਇੱਕ ਬਹੁਤ ਹੀ ਜਿਆ ਮਤਲਬ ਕਿ ਆਈ ਐਮ ਟਰੈਵਲਹੋਲੀਕ ਪਰਸਨ ਮੈਨੂੰ ਘੁੰਮਣਾ ਬਹੁਤ ਜ਼ਿਆਦਾ ਪਸੰਦ ਹੈਗਾ ਹੈ ਮੈਂ ਆਪਣੀ ਫੈਮਲੀ ਨਾਲ ਆਪਣੇ ਫਰੈਂਡਸ ਨਾਲ ਆਪਣੇ ਕਜ਼ਨਜ ਨਾਲ ਘੁੰ ਘੁੰਮਣਾ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਜਿਵੇਂ ਕਿ ਅਲੱਗ ਅਲੱਗ ਸ਼ਹਿਰਾਂ ਵਿੱਚ ਹੋ ਗਿਆ ਜਿਵੇਂ ਮੈਂ ਆਪਣੀ ਪੜ੍ਹਾਈ ਵੀ ਬੜੀ ਜ਼ਿਆਦਾ ਮਤਲਬ ਘੁੰਮ ਘੁੰਮ ਕੇ ਕੀਤੀ ਆ ਅਗਰ ਦੋ ਸਾਲ ਇੱਥੇ ਦੋ ਸਾਲ ਉੱਥੇ ਸੋ ਇਹਨੂੰ ਮਤਲਬ ਕਿ ਅਲੱਗ ਅਲੱਗ ਸ਼ਹਿਰਾਂ ਦਾ ਮਤਲਬ ਕਿ ਵਿਊ ਕੈਪਚਰ ਕਰਨਾ ਇਨਵਾਇਰਮੈਂਟ ਚੈੱਕ ਕਰਨਾ ਉਹਨਾਂ ਦੀ ਲੋਕਾਂ ਨਾਲ ਰਹਿਣਾ ਸਹਿਣਾ ਬਹਿਣਾ ਮਤਲਬ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਮੈਨੂੰ ਬੜਾ ਹੀ ਜ਼ਿਆਦਾ ਵਧੀਆ ਲੱਗਦਾ ਅਤੇ ਮੈਂ ਮਤਲਬ ਆਪਣੇ ਭੈਣ ਭਰਾਵਾਂ ਨਾਲ ਘੁੰਮਣਾ ਬਹੁਤ ਜ਼ਿਆਦਾ ਪਸੰਦ ਕਰ ਰਹੀ ਰੀਸੈਂਟਲੀ ਅਸੀਂ ਆਪ ਅਸੀਂ ਸਾਰੇ ਭੈਣ ਭਰਾ ਹਿਮਾਚਲ ਗਏ ਸੀ ਉੱਥੇ ਸਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਕਿ ਉੱਥੋਂ ਦਾ ਇਨਵਾਇਰਮੈਂਟ ਇੰਨਾ ਵਧੀਆ ਸੀਗਾ ਉੱਥੋਂ ਦੇ ਲੋਕ ਇੰਨੇ ਵਧੀਆ ਸੀਗੇ ਵਿਊ ਕੈਪਚਰ ਕਰਨਾ ਖਾਣਾ ਪੀਣਾ ਉੱਥੇ ਜਾ ਕੇ ਮਤਲਬ ਉੱਥੋਂ ਉੱਥੋਂ ਬਹੁਤ ਜ਼ਿਆਦਾ ਪਹਾੜੋਂ ਕੀ ਮੈਗੀ ਬਹੁਤ ਹੀ ਜ਼ਿਆਦਾ ਪਸੰਦ ਹੈ ਮੇਰੇ ਕੋ ਐਂਡ ਕਿਉਂਕਿ ਮਤਲਬ ਕਿ ਆਪਾਂ ਆਪਾਂ ਨੂੰ ਘੁੰਮਣਾ ਚਾਹੀਦਾ ਹੈ ਉਹਦੇ ਨਾਲ ਮਤਲਬ ਕਿ ਆਪਾਂ ਨੂੰ ਅਲੱਗ ਅਲੱਗ ਮਤਲਬ ਲੋਕਾਂ ਦਾ ਪਤਾ ਲੱਗ ਜਾਂਦਾ ਹੈ ਅਲੱਗ ਅਲੱਗ ਸ਼ਹਿਰਾਂ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਕਿਵੇਂ ਰਹਿੰਦੇ ਆ ਕਿਵੇਂ ਨਹੀਂ ਉਹਨਾਂ ਦਾ ਸਾਡੇ ਨਾਲੋਂ ਉਹ ਥੋੜ੍ਹਾ ਖਾਣਾ ਪਹਿਰਾਵਾ ਇਹ ਸਾਰਾ ਕੁਝ ਚੇਂਜ ਹੁੰਦਾ ਹੈ ਅਤੇ ਸਾਨੂੰ ਮਤਲਬ ਕਿ ਅਲੱਗ ਅਲੱਗ ਲੋਕਾਂ ਦੀਆਂ ਲਾਈਫ ਸਟਾਈਲ ਨੂੰ ਵੀ ਫੋਲੋ ਕਰਨਾ ਚਾਹੀਦਾ ਹੈ ਵੈਸਟਰਨ ਫੋਲੋ ਕਰਨਾ ਚਾਹੀਦਾ ਹੈ ਅਤੇ ਘੁੰਮਣਾ ਵੀ ਚਾਹੀਦਾ ਹੈ ਆਪਣੀ ਫੈਮਲੀ ਦੇ ਨਾਲ ਸਪੈਸ਼ਲੀ ਆਪਣੀ ਫੈਮਿਲੀ ਨਾਲ ਕਿਉਂਕਿ ਜਿਹੜੀ ਆਪਣੀ ਫੈਮਲੀ ਹੁੰਦੀ ਆ ਉਹਨਾਂ ਨਾਲ ਆਪਾਂ ਨੂੰ ਕਿਤੇ ਆਪਾਂ ਨੂੰ ਬਾਹਰ ਵੀ ਜਾਣਾ ਪੈ ਜਾਵੇ ਨਾ ਜਿਵੇਂ ਆਪਾਂ ਨੂੰ ਕੋਈ ਜਿਵੇਂ ਹੁਣ ਰੀਸੈਂਟਲੀ ਮੇਰੀ ਇਸ ਫੈਮਲੀ ਉਹ ਹੁਣ ਮਤਲਬ ਆਪਾਂ ਸਾਰੇ ਜਣੇ ਚੱਲੇ ਹਾਂ ਆਨੰਦਪੁਰ ਸਾਹਿਬ ਠੀਕ ਆ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਕ ਹੈਗਾ ਇਹ ਠੀਕ ਆ ਵੀ ਬਹੁਤ ਜ਼ਿਆਦਾ ਚਾਅ ਚੜਿਆ ਕਿ ਅਸੀਂ ਸਾਰੇ ਜਣੇ ਘੁੰਮਣ ਜਾਵਾਂਗੇ ਹੈ ਨਾ ਲਾਈਕ ਉੱਥੇ ਜਾ ਕੇ ਅ ਫੋਟੋਜ਼ ਕਲਿੱਕ ਕਰਾਂਗੇ ਉੱਥੇ ਖਾਣਾ ਖਾਵਾਂਗੇ ਘੁੰਮਾਂਗੇ ਇੱਕ ਦੂਜੇ ਨਾਲ ਮਤਲਬ ਮੂਵਮੈਂਟਸ ਬਣ ਜਾਂਦੀਆਂ ਆਪਣੀਆਂ ਮੈਮਰੀਜ਼ ਬਣ ਜਾਂਦੀਆਂ ਹੈ ਜਿਹਦੇ ਨਾਲ ਆਪਾਂ ਮਤਲਬ ਕਿ ਬਹੁਤ ਹੀ ਜ਼ਿਆਦਾ ਜਦੋਂ ਆਪਾਂ ਪੁਰਾਣੀਆਂ ਪਿਕਚਰਸ ਦੇਖਦੇ ਹਾਂ ਠੀਕ ਆ ਆਪਾਂ ਨੂੰ ਯਾਦ ਰਹਿੰਦਾ ਹਾਂ ਯਾਰ ਮੈਂ ਇੱਥੇ ਵੀ ਗਈ ਸੀਗੀ ਮੈਂ ਉੱਥੇ ਵੀ ਗਈ ਸੀਗੀ ਠੀਕ ਆ ਕਿੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਸੋ ਤੁਹਾਨੂੰ ਵੀ ਸਾਰਿਆਂ ਨੂੰ ਠੀਕ ਆ ਘੁੰਮਣ ਜਾਣਾ ਚਾਹੀਦਾ ਹੈ ਅਤੇ ਘੁੰਮਣਾ ਸਾਨੂੰ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਹੈਗਾ ਹੈ ਅਤੇ